ਪੰਜਾਬੀ ਭਾਸ਼ਾ ਵਿੱਚ ਦਿਲਚਸਪ ਬਹੁਤ ਸ਼ ਸਾਰੇ ਸ਼ਬਦ ਜਾਂ ਵਾਕੰਸ਼ ਹਨ ਜਿਵੇਂ ਕਿ ਦਿਲ ਨੂੰ ਛੂਹ ਲੈਣ ਵਾਲੀ ਇਹ ਕਈ ਤਰ੍ਹਾਂ ਦੇ ਜਿਵੇਂ ਕਿ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਧੰਨਵਾਦ ਆਦਿ ਬਹੁਤ ਸਾਰੇ ਸ਼ਬਦ ਹਨ ਜੋ ਕਿ ਸਾਡੇ ਮਨ ਦੀ ਫੀਲਿੰਗ ਨੂੰ ਦੂਸਰੇ ਇਨਸਾਨ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ ਖ਼ਾਸ ਤੌਰ 'ਤੇ ਦਿਲਚਸਪ ਅਤੇ ਧਿਆਨ ਦੇਣ ਯੋਗ ਜੋ ਕਿ ਮੇਰੇ ਦਿਲ ਦੇ ਕਰੀਬ ਜੋ ਪੰਜਾਬੀ ਭਾਸ਼ਾ ਦਾ ਇੱਕ ਵਾਕ ਜਾਂ ਤੁੱਕ ਵਾਕ ਜਾਂ ਤੁੱਕ ਜਿੰਨਾ ਜਿਹਨੂੰ ਕਿਹਾ ਜਾਂਦਾ ਹੈ ਉਹ ਇਹ ਹੈ ਕਿ ਉਹ ਇਹ ਹੈ ਕਿ ਸੁੱਖ ਵੇਲੇ ਅਰਦਾਸ ਕਿ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਜੋ ਕਿ ਮੇਰੇ ਦਿਲ ਦੇ ਬਹੁਤ ਕਰੀਬ ਹੈ ਤੋਂ ਮੈਨੂੰ ਪਰਮਾ ਤਾਂ ਮੈਨੂੰ ਪਰਮਾਤਮਾ ਦੇ ਨਾਲ ਜੋੜੇ ਰੱਖਦਾ ਹੈ